ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਕੁਝ ਕਰ ਦਿਨਾਂ ਪਹਿਲੇ ਮੇਰੇ ਘਰ ਵਾਲੇ ਬਾਹਰ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਸਨ ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਅੰਬਰਸਰ ਗੋਲਡਨ ਟੈਂਪਲ ਘੁੰਮਣ ਜਾਵਾਂਗੇ ਤਾਂ ਇਸ ਬਾਰੇ ਮੈਂ ਆਪਣੇ ਦੋਸਤ ਨੂੰ ਦੱਸਿਆ ਤਾਂ ਉਸ ਨੇ ਮੈਨੂੰ ਦੱਸਿਆ ਕਿ ਅੱਜ ਕੱਲ ਔਨਲਾਈਨ ਟੈਕਸੀ ਬੁੱਕ ਹੋ ਜਾਂਦੀ ਹੈ ਤਾਂ ਉਸ ਨੇ ਮੈਨੂੰ ਤੁਹਾਡੀ ਵੈਬਸਾਈਟ ਬਾਰੇ ਦੱਸਿਆ ਤਾਂ ਮੈਂ ਤੁਹਾਡੀ ਵੈਬਸਾਈਟ ਤੋਂ ਇੱਕ ਕੈਬ ਬੁੱਕ ਕਰਵਾਈ ਜਿਸ ਦਾ ਨੰਬਰ ਉੱਨੀ ਪਚਾਨਵੇਂ ਜੇ ਕੇ ਦੋ ਜ਼ੀਰੋ ਦੋ ਸੀ ਤਾਂ ਉਸ ਉਸ ਦੇ ਡਰਾਈਵਰ ਨੂੰ ਮੈਂ ਫੋਨ ਕੀਤਾ ਉਸਨੇ ਇਹ ਦੱਸਿਆ ਕਿ ਉਸ 'ਚ ਟਾਈਮ ਆ ਰਿਹਾ ਸੀ ਕਿ ਸਵੇਰੇ ਸੱਤ ਵਜੇ ਕੈਬ ਗਾਂਧੀ ਚੌਂਕ ਨ ਲ ਲਕਸ਼ਮੀ ਨਾਰਾਇਣ ਮੰਦਰ ਨੇੜੇ ਆ ਜਾਵੇਗੀ ਤਾਂ ਅਸੀਂ ਸਵੇਰ ਦੇ ਸੱਤ ਵਜੇ ਉਸ ਜਗ੍ਹਾ 'ਤੇ ਪਹੁੰਚ ਗਏ ਉਸ ਜਗ੍ਹਾ 'ਤੇ ਪਹੁੰਚਣ ਤੋਂ ਬਾਅਦ ਅਸੀਂ ਘੱਟੋ ਘੱਟ ਕੋਈ ਘੰਟਾ ਉਡੀਕਣ ਤੋਂ ਬਾਅਦ ਉਡੀਕਦੇ ਉਡੀਕ ਉਡੀਕਿਆ ਅਤੇ ਡਰਾਈਵਰ ਉੱਥੇ ਨਹੀਂ ਪਹੁੰਚਿਆ ਅਸੀਂ ਡਰਾਈਵਰ ਨੂੰ ਫੋਨ ਲਾਏ ਉਸਨੇ ਦਸ ਬਾਰ੍ਹਾਂ ਫੋਨ ਤੋਂ ਬਾਅਦ ਵੀ ਫੋਨ ਨਹੀਂ ਚੱਕੇ ਅਸੀਂ ਉਸ ਦੀ ਲੋਕੇਸ਼ਨ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹੀਂ ਹੋ ਰਹੀ ਇਸ ਕਰਕੇ ਮੈਨੂੰ ਜਾਂ ਤਾਂ ਉਸ ਡਰਾਈਵਰ ਨੂੰ ਛੇਤੀ ਤੋਂ ਛੇਤੀ ਲੋਕੇਸ਼ਨ 'ਤੇ ਭੇਜਿਆ ਜਾਵੇ ਜਾਂ ਉਸ ਦੀ ਜਗ੍ਹਾ ਕੋਈ ਨਵਾਂ ਡਰਾਈਵਰ ਸਾਡੀ ਲੋਕੇਸ਼ਨ 'ਤੇ ਭੇਜੀ ਜਾਵੇ